ਹਾਂਜੀ ਮੌਸਮ ਦੇ ਬਹੁਤ ਐਤਕੀ ਗਰਮੀ ਦੀ ਰੁੱਤ ਤੋਂ ਵੀ ਬਚੇ ਗਏ ਸੀ ਅਤੇ ਹੁਣ ਮੌਸਮ ਬਹੁਤ ਵਧੀਆ ਚੱਲ ਰਿਹਾ ਹੈ ਕਿ ਹੁਣ ਬਰਸਾਤ ਦਾ ਟਾਈਮ ਆ ਗਿਆ ਅਤੇ ਇਸ ਤੋਂ ਪਹਿਲਾਂ ਦੋ ਸਾਲ ਪਹਿਲਾਂ ਸਾਡੇ ਸਤਲੁਜ ਦਰਿਆ ਦੇ ਕੰਢੇ 'ਤੇ ਆਈ ਆਈ ਟੀ ਬਣੀ ਹੋਈ ਹੈ ਅਤੇ ਸਾਡਾ ਪਿੰਡ ਵੀ ਹਵੇਲੀ ਕਲਾਂ ਹੈ ਕੀ ਜੋ ਕਿ ਪਾਣੀ ਸੜਕ ਦੇ ਉੱਪਰ ਨੂੰ ਉੱਛਲ ਕੇ ਸਾਡੇ ਰੋਪੜ ਜ਼ਿਲ੍ਹੇ ਦਾ ਬਹੁਤ ਨੁਕਸਾਨ ਹੋਇਆ ਹੈ ਕਿ ਸਰਕਾਰ ਕੁਝ ਪਹਿਲਾਂ ਧਿਆਨ ਨਹੀਂ ਦਿੰਦੀ ਇਹਨਾਂ ਕੰਮ ਸੜਕਾਂ ਦੇ ਬੰਨ੍ਹਾਂ ਦੇ ਪ ਕੰਮ ਕਰਨ ਦਾ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਫੇਰ ਆ ਕੇ ਆਪਣੀ ਫਾਰਮੈਲਟੀਆਂ ਪੂਰੀਆਂ ਕਰਨ ਲੱਗ ਜਾਂਦੇ ਹਨ ਇਸ ਕਰਕੇ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਹੈ